ਪੰਜਾਬ ਦੀਆਂ ਕਈ ਮੁੱਖ ਸਿਆਸੀ ਪਾਰਟੀਆਂ ਹੈਗੀਆਂ ਜਿਵੇਂ ਕਿ ਇੰਡੀਆ ਨੈਸ਼ਨਲ ਕਾਂਗਰਸ ਹੈ ਸ਼੍ਰੋਮਣੀ ਅਕਾਲੀ ਦਲ ਹੈ ਬੀ ਜੇ ਪੀ ਹੈ ਅਤੇ ਅੱਜ ਕੱਲ ਆਮ ਆਦਮੀ ਪਾਰਟੀ ਚੱਲ ਰਹੀ ਹੈ ਇਹਨਾਂ ਪਾਰਟੀਆਂ ਨੇ ਆਪਣੀ ਆਪਣੀ ਸ਼ਾਸਨ ਦੇ ਦੌਰਾਨ ਅਲੱਗ ਅਲੱਗ ਢੰਗਾਂ ਨਾਲ ਰਾਜ ਦੇ ਇਤਿਹਾਸ ਅਤੇ ਸ਼ਾਸਨ ਨੂੰ ਨਵਾਂ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਇਹਨਾਂ ਕੋਸ਼ਿਸ਼ਾਂ ਵਿੱਚੋਂ ਆਪਾਂ ਕੁਛ ਕੁ ਦਾ ਜ਼ਿਕਰ ਇੱਦਾਂ ਕਰ ਸਕਦੇ ਹਾਂ ਜਿਵੇਂ ਕਿ ਚੱਪੜਚਿੜੀ ਯਾਦਗਾਰ ਬਣਾਈ ਹੈ ਇਸ ਤੋਂ ਇਲਾਵਾ ਨਵਾਂ ਸ਼ਹਿਰ ਦਾ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਰੱਖਿਆ ਗਿਆ ਏ ਜ਼ਿਲ੍ਹੇ ਦਾ ਨਾਮ ਅਤੇ ਅਗ ਅਨੰਦਪੁਰ ਸਾਹਿਬ ਦੇ ਵਿੱਚ ਵਿਰਾਸਤ ਏ ਖਾਲਸਾ ਬਣਾਈ ਹੈ ਇਸ ਤਰ੍ਹਾਂ ਹੋਰ ਵੀ ਪਾਰਟੀਆਂ ਅਲੱਗ ਅਲੱਗ ਤੌਰ 'ਤੇ ਕੰਮ ਕਰਦੀਆਂ ਅੱਜ ਕੱਲ ਆਮ ਆਦਮੀ ਪਾਰਟੀ ਨੇ ਹੁਣੇ ਰੀਸੈਂਟਲੀ ਛੁੱਟੀ ਕੀਤੀ ਹੈ ਸੌਲ੍ਹਾਂ ਨਵੰਬਰ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਦੇ ਵਿੱਚ ਸੋ ਇਹ ਪਾਰਟੀਆਂ ਦਾ ਆਪਣਾ ਆਪਣਾ ਏਜੰਡਾ ਰਹਿੰਦਾ ਆ ਕਿ ਵੱਧ ਤੋਂ ਵੱਧ ਪੰਜਾਬੀ ਲੋਕਾਂ ਨੂੰ ਕਿਵੇਂ ਆਪਣੇ ਨਾਲ ਜੋੜਨਾ ਆ ਸੋ ਉਹਦੇ ਅਕੋਰਡਿੰਗ ਇਹ ਆਪਣਾ ਆਪਣਾ ਕੰਮ ਕਰੀ ਜਾਂਦੇ ਆ ਕਈ ਵਾਰੀ ਸੜਕਾਂ ਦਾ ਨਾਮ ਵੀ ਚੇਂਜ ਕਰ ਦਿੱਤਾ ਕੀਤਾ ਜਾਂਦਾ ਸ਼ਹੀਦਾਂ ਦੇ ਨਾਮ 'ਤੇ ਜਾਂ ਦੇਸ਼ ਭਗਤਾਂ ਦੇ ਨਾਮ 'ਤੇ ਰੱਖਿਆ ਜਾਂਦਾ ਉਹ ਸੋ ਇਹਨਾਂ ਦਾ ਹਰ ਇੱਕ ਦਾ ਆਪਣਾ ਆਪਣਾ ਪਾਰਟੀ ਏਜੰਡੇ ਦੇ ਅਧੀਨ ਇਹ ਕੰਮ ਕਰਦੇ ਆ ਅਤੇ ਇਤਿਹਾਸ ਨੂੰ ਜਿੰਦਾ ਰੱਖਣ ਦੀ ਕੋਸ਼ਿਸ਼ ਕਰਦੇ ਆ ਜਾਂ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਕੋਸ਼ਿਸ਼ ਇਹੋ ਜਿਹੇ ਕੀਤੀਆਂ ਜਾਂਦੀਆਂ ਲਗਾਤਾਰ ਸੋ ਇੱਕ ਵਧੀਆ ਕੰਮ ਵੀ ਹੈਗਾ ਇਹਨਾਂ ਦਾ ਇਹ ਕਿ ਜਿਵੇਂ ਹੁਣ ਇਤਿਹਾਸ ਨਾਲ ਇਵੇਂ ਬੱਚਾ ਜੁੜਿਆ ਰਹਿੰਦਾ ਆ ਵੀ ਉਹਨੂੰ ਪਤਾ ਲੱਗਦਾ ਕਿ ਕਿਵੇਂ ਸਾਡੇ ਇਤਿਹਾਸ ਵਿੱਚ ਕੀ ਕੀ ਹੋਇਆ ਸੀ ਕਿਹੜੇ ਸ਼ਹੀਦ ਦੇ ਨਾਮ 'ਤੇ ਕੋਈ ਸੜਕ ਰੱਖੀ ਆ ਜਾਂ ਕੋਈ ਇਮਾਰਤ ਬਣਾਈ ਗਈ ਆ ਜਿਸ ਤਰ੍ਹਾਂ ਇਹ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਟਾਈਮ ਦੇ ਸ਼ਾਸਨ ਕਾਲ ਦੇ ਦੌਰਾਨ ਇਹ ਕੰਮ ਕੀਤੇ ਜਾਂਦੇ ਹੈ